ਪੁਰਾਣੇ ਸਮੇਂ ਨਾਲੋਂ ਹੁਣ ਦੇ ਸਮੇਂ ਵਿੱਚ ਤਾਂ ਕਾਫੀ ਹੀ ਬਦਲਾਵ ਆ ਗਿਆ ਹੈ ਪੁਰਾਣੇ ਸਮੇਂ ਵਿੱਚ ਚੁੱਲੇ ਹੁੰਦੇ ਸੀ ਅਤੇ ਚੁੱਲੇ ਜਦੋਂ ਅਸੀਂ ਅੱਗ ਬਾਲਦੇ ਹੁੰਦੇ ਸੀਗੇ ਉਦੋਂ ਕਾਫੀ ਟਾਈਮ ਲੱਗ ਜਾਂਦਾ ਸੀ ਕਈ ਵੇਲੇ ਲੱਕੜਾਂ ਗਿੱਲੀਆਂ ਹੋ ਜਾਂਦੀਆਂ ਸੀ ਤਾਂ ਕਰਕੇ ਰਾਤ ਦੀ ਰੋਟੀ ਜਾਂ ਸਵੇਰ ਦਾ ਨਸ਼ਤਾ ਵੀ ਲੇਟ ਹੋ ਜਾਂਦਾ ਸੀ ਹੁਣ ਦੇ ਟਾਈਮ ਵਿੱਚ ਤਾਂ ਇਲੈਕਟਸਿਟੀ ਚੁੱਲੇ ਆ ਗਏ ਆ ਗਏ ਹਨ ਅਤੇ ਗੈਸ ਚੁੱਲਾ ਵੀ ਆ ਗਿਆ ਹੈ ਜੋ ਕਿ ਬਹੁਤ ਫ਼ਾਇਦੇਮੰਦ ਹੈ ਇਹਨਾਂ ਦੇ ਫ਼ਾਇਦੇ ਬਹੁਤ ਹਨ ਅਤੇ ਜੋ ਵੀ ਅਸੀਂ ਜੋ ਵੀ ਅਸੀਂ ਕੰਮ ਇੰਨੇ ਇੰਨਾ ਸਮਾਂ ਲਗਾ ਕੇ ਕੰਮ ਕਰਦੇ ਹਾਂ ਉਹ ਸਾਡਾ ਕੁਛ ਮਿੰਟਾਂ ਵਿੱਚ ਹੀ ਹੋ ਜਾਂਦਾ ਹੈ ਜੇ ਅਸੀਂ ਗੱਲ ਕਰੀਏ ਮਿਕਸੀ ਦੀ ਅ ਪਹਿਲੇ ਜ਼ਮਾਨੇ ਵਿੱਚ ਕੁੰਡਾ ਘੋਟਨਾ ਹੁੰਦਾ ਸੀ ਅਤੇ ਸਿਲਵੱਟਾ ਹੁੰਦਾ ਸੀ ਜੋ ਕਿ ਇੱਕ ਤਾਂ ਸਾਡੀ ਐਨਰਜੀ ਬਹੁਤ ਲ ਵੇਸਟ ਹੁੰਦੀ ਸੀਗੀ ਉਸ ਚੀਜ਼ ਨੂੰ ਕਹਿੰਦੇ ਟਾਈਮ ਦੀ ਵਰਤੋਂ ਬਹੁਤ ਜ਼ਿਆਦਾ ਹੋ ਜਾਂਦੀ ਸੀ ਅਤੇ ਸਾਨੂੰ ਹਰ ਇੱਕ ਥੋੜ੍ਹਾ ਥੋੜ੍ਹੀ ਥੋੜ੍ਹੀ ਚੀਜ਼ਾਂ ਥੋੜ੍ਹੇ ਥੋੜ੍ਹੇ ਟਾਈਮ ਤੱਕ ਮਿਕਸ ਮਿਕਸ ਮਿਕਸ ਕਰਦੇ ਹੁੰਦੇ ਸੀ ਅਸੀਂ ਕਿ ਉਹਨੂੰ ਪਹਿਲਾਂ ਥੋੜ੍ਹਾ ਥੋੜ੍ਹਾ ਪਹਿਲਾਂ ਪਾ ਕੇ ਉਸਤੋਂ ਬਾਅਦ ਉਹਨੂੰ ਕੂੰਡੇ ਘੋਟਣੇ ਵਿੱਚ ਉਹਨੂੰ ਪਹਿਲਾਂ ਕੁੱਟਣਾ ਉਸ ਤੋਂ ਬਾਅਦ ਹੋਰ ਪਾਉਣਾ ਹੈ ਅਤੇ ਅੱਜ ਕੱਲ੍ਹ ਦੀ ਮਿਕਸੀਆਂ ਜਿਹੜੀਆਂ ਆ ਗਈਆਂ ਆ ਗਈਆਂ ਹਨ ਜਿਹੜੀ ਇਲੈਕਟ੍ਰੀਸਿਟੀ ਵਾਲੀਆਂ ਉਹ ਇਸ ਚੀਜ਼ ਨੂੰ ਬਹੁਤ ਹੀ ਆਸਾਨੀ ਦੇ ਰੂਪ ਵਿੱਚ ਸਾਨੂੰ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਅਸੀਂ ਇਹਨਾਂ ਵਿੱਚ ਵੱਧ ਤੋਂ ਵੱਧ ਵੱਧ ਤੋਂ ਵੱਧ ਚਟਨੀ ਦੇ ਸਮਾਨ ਹੋ ਹੋਰ ਵੀ ਜੂਸ ਵਗੈਰਾ ਸਭ ਕੁਝ ਅਸੀਂ ਪਾ ਕੇ ਅਸੀਂ ਮਿਕਸ ਕਰਕੇ ਜਲਦੀ ਤੋਂ ਜਲਦੀ ਅਸੀਂ ਆਪਣੀ ਰੈਸਿਪੀ ਤਿਆਰ ਕਰ ਸਕਦੇ ਹਾਂ ਅਤੇ ਪਹਿਲੇ ਜਨ ਪਹਿਲੇ ਪਹਿਲੇ ਜਿਹੜੇ ਜ਼ਮਾਨੇ ਹੁੰਦੇ ਸੀਗੇ ਅਸੀਂ ਜਦੋਂ ਕਦੇ ਕੋਈ ਘਰੇ ਕੋਈ ਲੇਟ ਆ ਜਾਂਦਾ ਸੀਗਾ ਅਤੇ ਅਸੀਂ ਦੁਬਾਰਾ ਉਸ ਚੀਜ਼ ਨੂੰ ਗਰਮ ਕਰਦੇ ਸੀ ਗੈਸ ਉੱਤੇ ਬਾਈ ਚਾਂਸ ਜਦੋਂ ਸਾਡੇ ਕੋਲ ਗੈਸ ਚੁੱਲੇ ਨਹੀਂ ਹੁੰਦੇ ਸੀਗੇ ਅਤੇ ਅਸੀਂ ਚੁੱਲਾ ਚੁੱਲੇ 'ਤੇ ਅੱਗ ਬਾਲ ਕੇ ਉਸ ਤੋਂ ਬਾਅਦ ਉਹਨੂੰ ਗਰਮ ਕਰਦੇ ਹੁੰਦੇ ਸੀ ਰੋਟੀ ਨੂੰ ਬਟ ਜਦੋਂ ਦਾ ਅਵਨ ਆਇਆ ਹੈ ਅਤੇ ਉਦੋਂ ਦਾ ਜਦੋਂ ਦਾ ਅਵਨ ਆਇਆ ਹੈ ਉਦੋਂ ਦਾ ਅਸੀਂ ਜਦੋਂ ਵੀ ਜਦੋਂ ਵੀ ਅਸੀਂ ਕੋਈ ਠੰਡਾ ਖਾਣਾ ਅਸੀਂ ਗਰਮ ਕਰਨਾ ਹੁੰਦਾ ਜਸਟ ਅਸੀਂ ਉਹਦੇ ਵਿੱਚ ਅਵਨ ਵਿੱਚ ਰੱਖ ਕੇ ਅਸੀਂ ਦੋ ਤਿੰਨ ਸੈਕਿੰਡ ਵਿੱਚ ਹੀ ਅਸੀਂ ਗਰਮ ਗਰਮ ਗਰਮ ਭੋਜਨ ਅਸੀਂ ਪ੍ਰਾਪਤ ਕਰ ਲੈਂਦੇ ਹਾਂ ਸਿਲੰਡਰ ਦੀ ਵਰਤੋਂ ਵੀ ਕਾਫੀ ਚੀਜ਼ਾਂ ਵਿੱਚ ਵਰਤੀ ਗਈ ਹੈ ਗੈਸ ਚੁੱਲੇ ਵਿੱਚ ਵੀ ਸਿਲਿੰਡਰ ਦੀ ਵਰਤੋਂ ਕੀਤੀ ਜਾਂਦੀ ਅੱਜ ਕੱਲ੍ਹ ਤਾਂ ਬਹੁਤ ਹੀ ਚੀਜ਼ਾਂ ਨੇ ਜਿਨ੍ਹਾਂ ਵਿੱਚ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਗੈਸ ਗੈਸ ਦੀ ਵਰਤੋਂ ਅਸੀਂ ਗੀਜ਼ਰਾਂ ਵਿੱਚ ਵੀ ਲੈਂਦੇ ਹਾਂ ਜੋ ਕਿ ਸਿਲੰਡਰ ਦੇ ਨਾਲ ਅਟੈਚ ਕਰਕੇ ਅਸੀਂ ਗੈਸ ਦੀ ਵਰਤੋਂ ਕਰਦੇ ਹਾਂ ਘਰਾਂ ਵਿੱਚ